ਸਕੂਲਾਂ ਵਿੱਚ ਬਹੁਤ ਸਾਰੇ ਵਿਸ਼ੇ ਪੜ੍ਹਾਏ ਜਾਂਦੇ ਹਨ ਜਿਵੇਂ ਕਿ ਮੈਥ ਪੜ੍ਹਾਇਆ ਜਾਂਦਾ ਹੈ ਅੰਗਰੇਜ਼ੀ 'ਤੇ ਫੋਕਸ ਕੀਤਾ ਜਾਂਦਾ ਹੈ ਪੰਜਾਬੀ ਤਾਂ ਹੈ ਗਈ ਹੈ ਗਈ ਜੋ ਸਾਡੀ ਲੈਂਗੁਏਜ ਆ ਹਿੰਦੀ ਵੀ ਪੜ੍ਹਾਈ ਜਾਂਦੀ ਸਾਇੰਸ ਪੜ੍ਹਾਈ ਜਾਂਦੀ ਆ ਅਤੇ ਸਾਰੇ ਅਧਿਆਪਕ ਹੀ ਜਿਹੜੇ ਵੀ ਜਿਹੜੇ ਜਿਹੜੇ ਸਬਜੈਕਟ ਪੜਾਉਂਦੇ ਆ ਉਹ ਚੰਗੇ ਹੁੰਦੇ ਹਨ ਅਤੇ ਪੜ੍ਹੇ ਲਿਖੇ ਵੀ ਹੁੰਦੇ ਹਨ ਅਤੇ ਆਪਾਂ ਇਹ ਕੁਝ ਨਹੀਂ ਕਹਿ ਸਕਦੇ ਹੈਗੇ ਕਿ ਉਹ ਨਹੀਂ ਪੜ੍ਹੇ ਲਿਖੇ ਅਤੇ ਇਹ ਇੱਕ ਆਪਣੇ 'ਤੇ ਵੀ ਡਿਪੈਂਡ ਹੁੰਦਾ ਜਾਂ ਟੀਚਰ 'ਤੇ ਵੀ ਡਿਪੈਂਡ ਹੁੰਦਾ ਆ ਕਿ ਜੇਕਰ ਉਹ ਪੜ੍ਹਿਆ ਲਿਖਿਆ ਤਾਂ ਉਹ ਚੱਜ ਨਾਲ ਸਮਝਾਏਗਾ ਅਤੇ ਬੱਚਿਆਂ ਨੂੰ ਵੀ ਸਮਝ ਆਏਗਾ